ਹੈਲੋ ਜੀ ਪੇਂਟ ਵਾਲੇ ਬੋਲ ਰਹੇ ਓ ਹਾਂਜੀ ਮੈਂ ਨਾ ਪੇਂਟ ਬਾਰੇ ਪੁੱਛਣਾ ਸੀ ਅਸੀਂ ਨਾ ਹੁਣੇ ਮਕਾਨ ਬਨਾਇਆ ਨਵਾਂ ਤੇ ਪਲਸਤਰ ਵਗੈਰਾ ਦਾ ਸਾਰਾ ਕੰਮ ਹੋ ਗਿਆ ਹੁਣ ਅਸੀਂ ਪੇਂਟ ਕਰਵਾਨਾ ਐ ਤੇ ਇੱਕ ਅਸੀਂ ਵਈ ਡਾਊਨ ਸੀਲਿੰਗ ਕਰਵਾਨੀ ਐ ਛੱਤਾਂ ਤੇ ਹਾਂਜੀ ਤੇ ਕੀ ਨਾਮ ਤੁਸੀਂ ਫੇਰ ਵਈ ਦੱਸ ਦੋ ਮੈਨੂੰ ਸਾਰਾ ਕੀ ਸਾਬ ਕਿਤਾਬ ਐ ਇਨ ਦਾ ਹਾਂਜੀ ਹਾਂਜੀ ਹਾਂ ਥੋੜਾ ਜਿਆ ਕੋਮਬੀਨੇਸ਼ਨ ਬਨਵਾ ਕੇ ਈ ਕਰਵਾਨਾ ਐ ਹੂੰ ਹਾਂਜੀ ਹਾਂਜੀ ਹਾਂਜੀ ਉਹ ਵੀ ਕਰਵਾਨੇ ਆ

ਠੀਕ ਐ ਜੀ ਹਾਂ ਹਾਂ ਛੱਤ ਤੇ ਅਸੀਂ ਡਾਊਨ ਵਈ ਉਹ ਤੁਸੀਂ ਕਰ ਦਿੰਨੇ ਓ ਜਾਂ ਕਰਵਾਂਦੇ ਓ ਅੱਗੋਂ ਠੀਕ ਐ ਤੇ ਮਤਲਬ ਦਰਵਾਜੇ ਜਿਵੇਂ ਦਰਵਾਜਿਆਂ ਦੇ ਨਾਲ ਅਸੀਂ ਥੋੜਾ ਜਿਆ ਕੋਮਬੀਨੇਸ਼ਨ ਬਨਵਾ ਕੇ ਹੀ ਹੂੰ ਹੂੰ ਠੀਕ ਐ ਤੇ ਫਿਰ ਹਾਂ ਵਈ ਕਿਹੜਾ ਹੈਗਾ ਤੁਹਾਡੇ ਕੋਲ ਹੂੰ ਹੂੰ ਠੀਕ ਐ ਠੀਕ ਐ ਨਈਂ ਕੋਈ ਨੀ ਫਿਰ ਇੱਕ ਵਰੀ ਜਾਂ ਤੁਸੀਂ ਸਾਨੂੰ ਥੋੜਾ ਜਿਹਾ ਰੇਟ ਦਾ ਦੱਸ ਦਿਓ ਵਈ ਕਿਵੇਂ ਕੀ ਸਾਬ ਹੁੰਦਾ ਪੇਂਟ ਦਾ ਵੱਖਰੇ ਵੱਖਰੇ ਜਿਹੜੀ ਵੀ ਕੰਪਨੀ ਦਾ ਸਾਡੇ ਰੂਮ ਰੂਮ ਦਾ ਦੇਖੋ ਜੀ ਵੈਸੇ ਤਾਂ ਡਿਫਰੈਂਟ ਡਿਫਰੈਂਟ ਨੇ ਮਤਲਬ ਤੁਸੀਂ ਐਨਾ ਕ ਮੰਨ ਕੇ ਚੱਲੋ ਪੰਦਰਾਂ ਬਾਰਾਂ ਪੰਦਰਾਂ ਬਾਈ ਬਾਰਾਂ ਦੇ ਹੈਗੇ ਆ ਹੂੰ ਹੂੰ ਤੇ ਆਪਾਂ ਉਹ ਕਰਵਾਨੇ ਐ ਪੇਂਟ ਚਾਰ ਰੂਮ ਹੈਗੇ ਐ ਤੇ ਇੱਕ ਜਿਵੇਂ ਬਾਲਕਨੀ ਟਾਈਪ ਦਾ ਲੋਬੀ ਬਣੀ ਹੋਈ ਐ ਹਾਂਜੀ ਬਾਹਰਲੀ ਸਾਈਡ ਦਾ ਬਨਿਆ ਹਾਂਜੀ ਹਾਂਜੀ ਸਾਰਾ ਕਰਵਾਨਾ ਅਸੀਂ ਪੇਂਟ ਹਾਂ ਹਾਂ ਉੱਪਰ ਨੀਚੇ ਦੋਣੋਂ ਬਨੇ ਹੋਏ ਐ ਸਾਡੇ

ਹਾਂਜੀ ਠੀਕ ਐ ਠੀ ਠੀਕ ਐ ਫੇਰ ਤੁਸੀਂ ਆਜੋ ਮੈਂ ਐਡਰੈਸ ਸੈਂਡ ਕਰ ਦਿੰਨੇ ਆਂ ਤੁਸੀਂ ਆ ਕੇ ਦੇਖ ਲੋ ਤੇ ਥੋ ਜਿਹੜੀ ਕਲਰ ਪਲੇਟ ਹੁੰਦੀ ਐ ਤੁਹਾਡੇ ਕੋਲ ਓ ਪੂਰੀ ਮਤਲਬ ਉਹ ਦਿਖਾ ਦਿਓ ਮੈਨੂੰ ਹੂੰ ਹੂੰ ਠੀਕ ਐ ਠੀਕ ਐ ਹੂੰ ਠੀਕ ਐ ਚਲੋ ਫੇਰ ਹਾਂ ਹਾਂਜੀ ਬਸ ਆਹੀ ਕਰਵਾਨਾ ਜੀ ਪੇਂਟ ਦਾ ਈ ਅਸੀਂ ਹੂੰ ਡਾਊਨ ਸੀਲਿੰਗ ਦੇ ਵੀ ਡਿਜਾਇਨ ਤੁਸੀਂ ਲੈ ਆਇਆ ਜੇ ਨਾਲ ਹੂੰ ਠੀਕ ਐ ਜੀ ਥੈਂਕਿਊ